ਅੱਜ ਕੱਲ੍ਹ ਜਿਵੇਂ ਟੀ ਵੀ ਅਤੇ ਔਨਲਾਈਨ ਦਾ ਜ਼ਮਾਨਾ ਆ ਗਿਆ ਹੈ ਇਸ ਵਿੱਚ ਵਧੇਰੇ ਜਾਣਕਾਰੀ ਇੰਗਲਿਸ਼ ਵਿੱਚ ਜ਼ਿਆਦਾ ਸਾਂਝੀ ਕੀਤੀ ਜਾ ਨੀ ਜਾਂਦੀ ਹੈ ਮੈਂ ਜਿੰਨਾ ਕੁ ਮੈਨੂੰ ਮਤਲਬ ਕਿ ਲੱਗ ਰਿਹਾ ਕਿ ਪੰਜਾਬੀ ਚੈਨਲਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ ਔਨਲਾਈਨ ਵਿੱਚ ਜਿਵੇਂ ਔਨਲਾਈਨ ਸਿਸਟਮ ਹੈ ਹਨ ਉਹਨਾਂ 'ਚ ਤਾਂ ਜ਼ਿਆਦਾ ਅੰਗਰੇਜ਼ੀ ਨਿਊਜ਼ ਅਤੇ ਅੱਜ ਕੱਲ੍ਹ ਦੀ ਪੀੜ੍ਹੀ ਸਾਰੀ ਜਿੰਨੀ ਵੀ ਹੈ ਉਹ ਮਤਲਬ ਕਿ ਗਲਤ ਮਲਤ ਦੇਖ ਰਹੀ ਹੈ ਉਹ ਕੋਈ ਵੀ ਆਪਣੇ ਭਾਸ਼ਾ ਦੇ ਤੌਰ 'ਤੇ ਕੋਈ ਵੀ ਨਹੀਂ ਹੈ ਠੀਕ ਹੈ ਜੀ ਦੂਜਾ ਆਪਣਾ ਉਹ ਅਤੇ ਜਿੰਨਾ ਟੀ ਵੀ ਹੈ ਟੀ ਵੀ 'ਤੇ ਆਪਣਾ ਸਾਰੀ ਜਿੰਨੇ ਵੀ ਅੱਜ ਕੱਲ੍ਹ ਦੇ ਸਿਆਣੇ ਹੋ ਗਏ ਨਿਆਣੇ ਜੋ ਨਵੀਂ ਪੀੜ੍ਹੀ ਜੋ ਹੈ ਉਹ ਟੀ ਵੀ ਦੇ ਟੀ ਵੀ ਦਾ ਮਤਲਬ ਕਿ ਹੁਣ ਗਾਹਾਂ ਗਾਹਾਂ ਅੱਗੇ ਅੱਗੇ ਜਿਵੇਂ ਸਮਾਂ ਆ ਰਿਹਾ ਹੈ ਟੀ ਵੀ ਦਾ ਜ਼ੋਰ ਹੈ ਜੋ ਯੋਗ ਹੈ ਉਹ ਮੁੱਕਦਾ ਜਾ ਰਿਹਾ ਹੈ ਕਲਯੁੱਗ ਵਿੱਚ ਟੀ ਵੀ ਇੱਕ ਅਜਿਹੀ ਸੰਸਥਾ ਅਜਿਹੀ ਮਤਲਬ ਕਿ ਵਸਤੂ ਰਹਿ ਗਈ ਹੈ ਜੋ ਕਿ ਪਹਿਲਾਂ ਦੇ ਮੁਕਾਬਲੇ ਹੁਣ ਬਿਲਕੁਲ ਖਤਮ ਹੁੰਦੀ ਜਾ ਰਹੀ ਹੈ ਅੱਜ ਕੱਲ੍ਹ ਸਾਰੇ ਜੋ ਵੀ ਅੱਜ ਕੱਲ੍ਹ ਸਿਆਣੇ ਜੋ ਨਿਆਣੇ ਜੋ ਜੰਮਦੇ ਬੱਚੇ ਉਹ ਸਾਰੇ ਹੀ ਔਨਲਾਈਨ ਦਾ ਮਤਲਬ ਕਿ ਸ਼ਿਕਾਰ ਹੋ ਰਹੇ ਹੈ ਠੀਕ ਹੈ ਮੈਂ ਤਾਂ ਇਹੀ ਤਬਦੀਲੀ ਕਰਨਾ ਚਾਹਾਂਗਾ ਕਿ ਕੁਛ ਨਾ ਕੁਛ ਮਤਲਬ ਕਿ ਆਪਣੇ ਸੱਭਿਆਚਾਰ ਸਾਰੀ ਸੰਸਥਾ ਭੁੱਲਦੀ ਜਾ ਰਹੀ ਹੈ ਤਾਂ ਕਿਰਪਾ ਕਰਕੇ ਮੇਰੀ ਇੱਕੋ ਮਤਲਬ ਕਿ ਬੇਨਤੀ ਹੈ ਸਰਕਾਰ ਨੂੰ ਕਿ ਇਸ ਵਿੱਚ ਜਲਦ ਤੋਂ ਜਲਦ ਥੋੜ੍ਹਾ ਵੱਡਾ ਫੈਸਲਾ ਲਿਆ ਜਾਵੇ ਜੋ ਕਿ ਅੱਗੇ ਜਾ ਕੇ ਸਾਨੂੰ ਕਿਸੇ ਵੀ ਪ੍ਰਕਾਰ ਦੀ ਮੁਸੀਬਤ ਨਾ ਪੈ ਕੇ ਸਾਨੂੰ ਆਪਣਾ ਸੱਭਿਆਚਾਰ ਆਪਣੀ ਪੀੜ੍ਹੀ ਨੂੰ ਮਤਲਬ ਕਿ ਗਾਹਾਂ ਦਿਖਾਉਣਾ ਪਵੇ ਸਿਖਾਉਣਾ ਪਵੇ ਕਿ ਬਿਲਕੁਲ ਖਤਮ ਹੋ ਜਾਵੇ